ਕੁਝ ਸਾਲ ਪਹਿਲਾਂ ਪੁਰਾਣੇ ਮੋਬਾਈਲ ਕੀ ਕੀਪੈਡ ਹੁੰਦੇ ਸਨ ਜਿਨ੍ਹਾਂ ਦਾ ਸਾਈਜ਼ ਬਹੁਤ ਹੀ ਛੋਟਾ ਹੁੰਦਾ ਸੀ ਅਤੇ ਜੋ ਅੱਜ ਕੱਲ੍ਹ ਦੇ ਸਮਾਰਟਫੋਨ ਹਨ ਇਹ ਟੱਚ ਫੋਨ ਹਨ ਜਿਨ੍ਹਾਂ ਦਾ ਹਾਈ ਸਪੀਡ ਨੈੱਟਵਰਕ ਬਹੁਤ ਹੀ ਜ਼ਿਆਦਾ ਹੈ ਜਿਨ੍ਹਾਂ ਦਾ ਮਤਲਬ ਨੈੱਟਵਰਕ ਫਾਈਵ ਜੀ ਬੀ ਹੋਣ ਕਾਰਨ ਜਿਨ੍ਹਾਂ ਦੀ ਸਪੀਡ ਬਹੁਤ ਹੀ ਤੇਜ਼ ਹੈ ਅਤੇ ਆਪਾਂ ਹੁਣ ਦੇ ਮਤਲਬ ਜੋ ਮੋਬਾਈਲ ਫੋਨ ਹਨ ਨੈੱਟਵਰਕ ਤੇਜ਼ ਹੋਣ ਕਾਰਨ ਆਪਾਂ ਕੁਛ ਵੀ ਦੇਖ ਸਕਦੇ ਹਾਂ ਕੋਈ ਵੀ ਵੀਡੀਓ ਦੇਖ ਸਕਦੇ ਹਾਂ ਜੋ ਪਹਿਲਾਂ ਦੇ ਕੁਛ ਸਾਲ ਪੁਰਾਣੇ ਮੋਬਾਇਲ ਹੁੰਦੇ ਸਨ ਕੀਪੈਡ ਹੁੰਦੇ ਸਨ ਉਹਨਾਂ ਦਾ ਮੈਸੇਜ ਕਰਨ ਦਾ ਤਰੀਕਾ ਤਾਂ ਛੱਡੋ ਉਹਨਾਂ 'ਤੇ ਕੌਲ ਕਰਨ ਵਾਸਤੇ ਵੀ ਸਾਨੂੰ ਕਈ ਵਾਰ ਕੋਠਿਆਂ 'ਤੇ ਚੜ੍ਹਨਾ ਪੈਂਦਾ ਸੀ ਜਾਂ ਕੰਧਾਂ 'ਤੇ ਚੜ੍ਹਨਾ ਪੈਂਦਾ ਸੀ ਜਿਨ੍ਹਾਂ ਦਾ ਨੈੱਟਵਰਕ ਬਹੁਤ ਹੀ ਔਖਾ ਹੁੰਦਾ ਸੀ ਅਤੇ ਬਹੁਤ ਹੀ ਔਖਾ ਹੋਣ ਕਰਕੇ ਜੋ ਅੱਜ ਕੱਲ੍ਹ ਦਾ ਸਮਾਰਟਫੋਨ ਹੈ ਜਨਰੇਸ਼ਨ ਹੈ ਜੋ ਅੱਜ ਕੱਲ੍ਹ ਦੇ ਸਮਾਰਟਫੋਨ ਹਨ ਟੱਚ ਫੋਨ ਹਨ ਇਹਨਾਂ ਦਾ ਨੈੱਟਵਰਕ ਫਾਈਵ ਜੀ ਬੀ ਹੋਣ ਕਾਰਨ ਬਹੁਤ ਹੀ ਵਧੀਆ ਹੈ ਅਸੀਂ ਕਿਤੇ ਵੀ ਕਦੋਂ ਵੀ ਕਿਵੇਂ ਵੀ ਕੌਲ ਕਰ ਸਕਦੇ ਹਾਂ ਕਿਵੇਂ ਵੀ ਕੁਛ ਵੀ ਦੇਖ ਸਕਦੇ ਹਾਂ ਅਤੇ ਮੈਂ ਜੋ ਜੋ ਕਿ ਮੈਂ ਹਾਂ ਮੈਂ ਏਅਰਟੈਲ ਦੀ ਸਿਮ ਵਰਤਦੀ ਹਾਂ ਜਿਹਦਾ ਰੀਚਾਰਜ ਮੈਂ ਟੂ ਥਰਟੀ ਨਾਇਨ ਦਾ ਕਰਵਾਉਂਦੀ ਹਾਂ ਟੂ ਥਰਟੀ ਨਾਇਨ ਦੇ ਵਿੱਚ ਮੈਨੂੰ ਪਰ ਡੇਅ ਡੇਢ ਜੀ ਬੀ ਮਿਲਦਾ ਹੈ ਜੋ ਮੈਂ ਇੱਕ ਮਹੀਨੇ ਦੇ ਵਿੱਚ ਟੂ ਥਰਟੀ ਨਾਇਨ ਯੂਜ ਕਰ ਦਿੰਦੀ ਹਾਂ ਟੂ ਥਰਟੀ ਨਾਇਨ ਖਰਚ ਕਰ ਦਿੰਦੀ ਹਾਂ ਜਿਹਦੇ ਵਿੱਚ ਮੈਨੂੰ ਬਹੁਤ ਹੀ ਮਤਲਬ ਆਨੰਦ ਮਿਲਦਾ ਹੈ ਬਹੁਤ ਹੀ ਵਧੀਆ ਡੇਢ ਜੀ ਬੀ ਪਰ ਡੇਅ ਜੋ ਮੈਨੂੰ ਮਿਲਦਾ ਹੈ ਮੈਂ ਪੂਰਾ ਖਰਚਦੀ ਹਾਂ ਅਤੇ ਮੰਥਲੀ ਮੈਂ ਟੂ ਥਰਟੀ ਨਾਇਨ ਖਰਚ ਕਰ ਦਿੰਦੀ ਹਾਂ